ਰੋਪੜ ਸ਼ਹਿਰ ਵਿੱਚ ਪਸ਼ੂ ਪਾਲਣ ਦਾ ਧੰਦਾ ਬਹੁਤ ਵੱਡੇ ਤੌਰ 'ਤੇ ਕੀਤਾ ਜਾਂਦਾ ਹੈ ਇਹਨਾਂ ਵਿੱਚ ਗਾਵਾਂ ਭੇਡਾਂ ਬੱਕਰੀਆਂ ਮੁਰਗੀਆਂ ਮੱਝਾਂ ਵਗੈਰਾ ਆਉਂਦੀਆਂ ਹਨ ਭੇਡਾਂ ਵਗੈਰਾ ਤੋਂ ਉੱਨ ਮਿਲਦੀ ਹੈ ਜੋ ਕਿ ਕੱਪੜਾ ਬਣਾਉਣ ਦੇ ਕੰਮ ਆਉਂਦੀ ਹੈ ਗਊਆਂ ਤੋਂ ਗਊਆਂ ਵੀ ਘਰਾਂ ਵਿੱਚ ਰੱਖੀਆਂ ਜਾਂਦੀਆਂ ਹਨ ਜੋ ਕਿ ਪੈਸੇ ਦਾ ਸਾਧਨ ਹੈ ਦੁੱਧ ਦੁੱਧ ਪੀਣ ਨੂੰ ਮਿਲਦਾ ਹੈ ਅਤੇ ਦੁੱਧ ਵੇਚ ਕੇ ਪੈਸੇ ਵੀ ਵੱਟੇ ਜਾਂਦੇ ਹਨ ਇਹਨਾਂ ਨੂੰ ਦਾਣਾ ਵਧੀਆ ਤੋਂ ਵਧੀਆ ਪਾਉਂਣਾ ਚਾਹੀਦਾ ਹੈ ਤਾਂ ਜੋ ਸਾਨੂੰ ਦੁੱਧ ਦੀ ਗੁਣਵੱਤਾ ਵਧੀਆ ਮਿਲੇ ਬੱਕਰੀਆਂ ਵੀ ਰੱਖੀਆਂ ਜਾਂਦੀਆਂ ਹਨ ਅਤੇ ਮੁਰਗੀਆਂ ਵੀ ਰੱਖੀਆਂ ਜਾਂਦੀਆਂ ਹਨ ਮੁਰਗੀਆਂ ਤੋਂ ਆਂਡੇ ਵਗੈਰਾ ਲਏ ਜਾਂਦੇ ਹਨ ਜੋ ਕਿ ਪੈਸੇ ਦਾ ਸਾਧਨ ਹਨ ਅਤੇ ਮਾਸ ਲਈ ਵੀ ਮੁਰਗੀਆਂ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਮੈਂ ਮੱਝਾਂ ਰੱਖੀਆਂ ਹੋਈਆਂ ਹਨ ਮੱਝਾਂ ਨੂੰ ਸੁਬਾਹ ਪੱਠੇ ਵੀ ਪਾਈਦੇ ਹਨ ਅਤੇ ਧਾਰਾਂ ਚੌਈ ਦੀਆਂ ਹਨ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਦੀ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਅਤੇ ਸੁਬਾਹ ਸ਼ਾਮ ਦੁੱਧ ਡੇਅਰੀ ਲੈ ਕੇ ਜਾਇਆ ਜਾਂਦਾ ਹੈ ਡੇਅਰੀ ਵਿੱਚ ਵਧੀਆ ਸਾਫ਼ ਸੁਥਰੇ ਵਧੀਆ ਦੁੱਧ ਦੀ ਵਧੀਆ ਗੁਣਵੱਤਾ ਦੇ ਤੌਰ 'ਤੇ ਫੈਂਟ ਦੇ ਹਿਸਾਬ ਨਾਲ ਉਸਦੇ ਪੈਸੇ ਲੱਗਦੇ ਹਨ